ਅਸੀਂ ਜ਼ਿਮੀਂਦਾਰ ਹੈ ਜ਼ਿਮੀਂਦਾਰ ਫਸਲ ਉਗਾਉਂਦਾ ਹੈ ਫਿਰ ਬੀਜਦਾ ਠੀਕ ਹੈ ਫਿਰ ਉਹ ਇਕੱਲਾ ਨਹੀਂ ਬੀਜ ਸਕਦਾ ਜ਼ਿਮੀਂਦਾਰ ਪਹਿਲਾਂ ਖੇਤ ਜਾਊ ਖੇਤ ਵੀ ਕਿਸੇ ਦੀ ਹੈਲਪ ਲਵੇਗਾ ਲੇਬਰ ਵਾਲੇ ਬੁਲਾਏਗਾ ਤਾਂ ਨਾਲ ਜਾ ਕੇ ਖੇਤਾਂ ਦੀਆਂ ਵੱਟਾਂ ਪਾਉਣੀਆਂ ਠੀਕ ਹੈ ਖੇਤਾਂ ਦਾ ਵੱਟ ਪਾ ਕੇ ਫਿਰ ਉਹ ਦੀਆਂ ਡੋਲਾ ਪਾਉਣੀਆਂ ਖੇਤਾਂ ਦੀਆਂ ਦੋ ਚਾਰ ਬੰਦੇ ਹੋਣਗੇ ਫਿਰ ਇਕੱਠੇ ਕੰਮ ਕਰਨਗੇ ਆਪਾਂ ਲੇਬਰ ਲੈ ਕੇ ਆਪਾਂ ਬੀਜਦੇ ਉਹਨੂੰ ਕਣਕ ਨੂੰ ਅਤੇ ਇਕੱਲਾ ਬੰਦਾ ਜ਼ਿਮੀਂਦਾਰ ਕੁਛ ਨਹੀਂ ਹੈ ਇਕੱਲਾ ਬੰਦਾ ਕੁਛ ਜ਼ਿਮੀਂਦਾਰ ਕਰੇ ਸਕਦਾ ਪੰਜ ਸੱਤ ਬੰਦੇ ਜ਼ਿਮੀਂਦਾਰ ਲੈ ਕੇ ਤਾਂ ਕੰਮ ਕਰਵਾਉਂਦਾ ਖੇਤੀ ਅਤੇ ਜਦੋਂ ਫਿਰ ਅਸੀਂ ਉਹਨੂੰ ਕੱਟਣਾ ਵੱਢਣਾ ਫਿਰ ਉਹਨਾਂ ਦੀ ਲੋੜ ਪੈਂਦੀ ਜ਼ਿਮੀਂਦਾਰ ਦੀ ਗੁਡਾਈ ਕਰਨੀ ਮੱਕੀ ਬੀਜ ਦਿੱਤੀ ਉਹਦੀ ਗੁਡਾਈ ਕਰਨ ਲਈ ਸਹਾਇਤਾ ਚਾਹੀਦੀ ਅਤੇ ਜ਼ਿਮੀਂਦਾਰ ਫਿਰ ਕਿਆ ਖੇਤਾਂ 'ਚ ਜਦੋਂ ਮੱਕੀ ਵੱਢਦਾ ਫਿਰ ਕਿਸੇ ਨੂੰ ਬੁਲਾ ਕੇ ਮੱਕੀ ਕਟਾਉਣੀ ਛਿਲਾਉਣੀ ਅਤੇ ਫਿਰ ਉਹਦਾ ਕੁੱਟਣੇ ਦੋ ਚਾਰ ਲੇਬਰ ਲਈ ਬਈਏ ਚਾਹੀਦੇ ਆਪਾਂ ਨੂੰ ਜਦੋਂ ਅਸੀਂ ਮੰਡੀ ਸੁੱਟ ਕੇ ਆਉਣੀ ਅਤੇ ਮੰਡੀ 'ਤੇ ਵੀ ਟਰਾਲੀ 'ਤੇ ਚੜ੍ਹਾਉਣਾ ਦੋ ਤਿੰਨ ਹੈਲਪਰ ਚਾਹੀਦੇ ਜ਼ਿਮੀਂਦਾਰਾਂ ਹੈਲਪਰ ਲੈ ਕੇ ਫਿਰ ਮੰਡੀ 'ਚ ਸੁੱਟ ਕੇ ਆਉਂਦਾ ਫਿਰ ਮੰਡੀ 'ਚ ਵੀ ਦੋ ਤਿੰਨ ਦਿਨ ਕਿਸਾਨ ਬੈਠਾ ਰਹਿੰਦਾ ਦੋ ਤਿੰਨ ਦਿਨ ਹੈਲਪ ਕਰਕੇ ਫਿਰ ਉਹਨਾਂ ਨੂੰ ਜਾ ਕੇ ਮੰਡੀ 'ਚ ਵਿਕਦੀ ਤਾਂ ਕਿਸਾਨ ਬਹੁਤ ਔਖਾ ਸਾਰੇ ਯੋਗਦਾਨ ਪਾ ਕੇ ਤਾਂ ਇੱਥੇ ਤੱਕ ਕਿਸਾਨ ਜ਼ਿਮੀਂਦਾਰਾਂ ਕਰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜ਼ਿਮੀਂਦਾਰ